ਹੈਲੋ ਹਾਂਜੀ ਕੋਣ ਹਾਂਜੀ ਤੁਸੀਂ ਕੋਣ ਹਾਂਜੀ ਹਾਂਜੀ ਬੋਲੋ ਅੱਛਿਆ ਜੀ ਕੋਈ ਨਾ ਜੇ ਮਤਲਬ ਕਿ ਮੈਂ ਵੀ ਲੈਤੀ ਹੈ ਜੀ ਮਾਨਸਾ ਇੱਕ ਬਹੁਤ ਵਧੀਆ ਗਾ ਇਹ ਮਾਨਸਾ ਬਸ ਸਟੈਂਡ ਦੇ ਕੋਲ ਹੀ ਹੈ ਜੀ ਬਹੁਤ ਵਧੀਆ ਪੜ੍ਹਾਈ ਵੀ ਮਤਲਬ ਕਿ ਟੀਚਰ ਵੀ ਬਹੁਤ ਵਧੀਆ ਨੇ ਹਾਂਜੀ ਸਰ ਬਹੁਤ ਵਧੀਆ ਨੇ ਮੰਥਲੀ ਦੋ ਹਜ਼ਾਰ ਮਤਲਬ ਜੀ ਬਹੁਤ ਵਧੀਆ ਪੜ੍ਹਾਉਂਦੇ ਨੇ ਮਤਲਬ ਕਿ ਤੁਸੀਂ ਅਗਾਂਹ ਕੀ ਕਰਨਾ ਚਾਹੁੰਦੇ ਹੋ ਨਾਲੇ ਤੁਹਾਡੇ ਕੋਲ ਪਲੱਸ ਵੰਨ ਪਲੱਸ ਟੂ 'ਚ ਕੀ ਸਟੀਮ ਸੀ ਉਹਦੇ ਅਕੋਰਡਿੰਗ ਤੁਹਾਨੂੰ ਕੋਈ ਨਾ ਕੋਈ ਵਧੀਆ ਦੱਸਣਗੇ ਅਤੇ ਆਪਣੇ ਜਿਹੜੇ ਨਿਊ ਟੀਚਰ ਆਏ ਨੇ ਉਹ ਮਤਲਬ ਆਪਣੇ ਰਿਸ਼ਤੇਦਾਰੀ 'ਚ ਹੀ ਹੈ ਉਹਨਾਂ ਦਾ ਫੀਸ ਦਾ ਆਪਾਂ ਵਾਧਾ ਘਾਟਾ ਵੀ ਕਰ ਲਾਂਗੇ ਹਾਂਜੀ ਮੈਂ ਦੋ ਹਜ਼ਾਰ ਦੱਸਿਆ ਸੀ ਜੀ ਮਤਲਬ ਕਿ ਜੇ ਤੁਸੀਂ ਥੋੜ੍ਹੀ ਕੁ ਲੈਸ ਕਰਵਾਉਣੀ ਹੋਵੇ ਉਹ ਕ ਕਰ ਦੇਣਗੇ ਬਾਕੀ ਜੇ ਤੁਹਾਨੂੰ ਨਹੀਂ ਵੀ ਪਤਾ ਕੋਈ ਨਹੀਂ ਮੈਂ ਤੁਹਾਨੂੰ ਲੈ ਜੂੰਗੀ ਮਤਲਬ ਇੰਨਾ ਕਾਫ਼ੀ ਦੂਰ ਦੂਰ ਤੱਕ ਨੇ ਆਪਣੇ ਲਈ ਸੰਗਰੂਰ ਪਟਿਆਲਾ ਕਾਫ਼ੀ ਮਤਲਬ ਕਿ ਫੇਸਮ ਵੀ ਕਾਫ਼ੀ ਨੇ ਅੱਛਿਆ ਜੀ ਹਾਂਜੀ ਡੈਮੋ ਦਿੰਦੇ ਨੇ ਇੱਕ ਦਿਨ ਨਹੀਂ ਜੀ ਡੈਮੋ ਫ੍ਰੀ ਹੈ ਹਾਂਜੀ ਮਤਲਬ ਕਿ ਟਾਈਮਿੰਗ ਇਹਦੀ ਨੌਂ ਤੋਂ ਬਾਰਾਂ ਜੀ ਵਿੱਚ ਆਪਾਂ ਜੇ ਤੁਸੀਂ ਈਵਨਿੰਗ ਟੈਮ ਵੀ ਲਾਉਣਾ ਚਾਹੁੰਦੇ ਹੋ ਉਹ ਵੀ ਲਾ ਸਕਦੇ ਹੋ ਨਹੀਂ ਇੱਕ ਵਾਰ ਉਰੇ ਲੈ ਕੇ ਦੇਖਿਓ ਤੁਹਾਨੂੰ ਬਹੁਤ ਵਧੀਆ ਰਿਜਲਟ ਮਿਲੂਗਾ ਮੈਂ ਅਤੇ ਮੈਂ ਹੁਣ ਕੀਤਾ ਕੋਰਸ ਹੁਣ ਮੈਂ ਅਗਾਂਹ ਭਰਿਆ ਗਾ ਉਮੀਦ ਹੈਗੀ ਆ ਕਿ ਜੋਬ ਮਿਲ ਜੂਗੀ ਹਾਂਜੀ ਹਾਂਜੀ ਹੈਗੇ ਮੂੰਹ ਲੱਗੇ ਨੇ ਮਤਲਬ ਕਿ ਆਪਣੇ ਰਿਸ਼ਤੇਦਾਰੀ ਚੋਂ ਹੀ ਆ ਜਾਂਦੇ ਆ ਹਾਂਜੀ ਕੋਈ ਨਾ ਜੀ ਮੈਂ ਚੱਲ ਜੂੰਗੀ ਨਾਲ ਨਹੀਂ ਮੈਂ ਤੁਹਾਨੂੰ ਉਹਨਾਂ ਦਾ ਹੁਣੇ ਨੰਬਰ ਸੈਂਡ ਏ ਕਰ ਦੂੰਗੀ